ਭਾਰਤੀ ਜਿਹੜੀ ਆਵਾਜਾਈ ਪ੍ਰਣਾਲੀ ਹੈ ਇਹ ਹੈ ਤਾਂ ਬਹੁਤ ਸਹੂਲਤਾਂ ਦਿੱਤੀਆਂ ਗਈਆਂ ਨੇ ਭਾਰਤ ਸਰਕਾਰ ਵੱਲੋਂ ਪਰ ਜਨਸੰਖਿਆ ਦੇ ਜ਼ਿਆਦਾ ਹੋਣ ਕਰਕੇ ਜਿਹੜੀਆਂ ਇਹ ਸਹੂਲਤਾਂ ਨੇ ਉਹਨਾਂ 'ਚ ਕਮੀ ਲੱਗਦੀ ਹੈ ਦੂਜੀ ਗੱਲ ਇਹ ਮੈਂ ਕਹਿਣੀ ਚਾਹੂੰਗੀ ਵੀ ਜਿਹੜੇ ਆਵਾਜਾਈ ਦੇ ਸਾਧਨ ਨੇ ਇੱਕ ਤਾਂ ਉਹ ਬਹੁਤ ਜ਼ਿਆਦਾ ਹੋਣੇ ਚਾਹੀਦੇ ਨੇ ਅਤੇ ਦੂਜੀ ਗੱਲ ਜਿਹੜੀ ਜਨਸੰਖਿਆ ਹੈ ਉਸ ਨੂੰ ਆਵਾਜਾਈ ਦੇ ਸਾਧਨਾਂ ਬਾਰੇ ਅਤੇ ਆਵਾਜਾਈ ਦੇ ਨਿਯਮਾਂ ਬਾਰੇ ਬਹੁਤ ਜ਼ਿਆਦਾ ਜਾਗਰੂਕ ਕਰਨਾ ਚਾਹੀਦਾ ਔਰ ਇਹ ਵੀ ਹੈ ਕਿਸੇ ਵੀ ਐਪਰੋਚ ਤੋਂ ਬਿਨਾਂ ਜਿਹੜੀ ਇੱਕ ਲਿਮਿਟਿਡ ਉਮਰ ਹੈ ਉਸ ਤੋਂ ਬਾਅਦ ਹੀ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਵਹੀਕਲ ਨੂੰ ਚਲਾਉਣ ਦੀ ਆਗਿਆ ਹੋਣੀ ਚਾਹੀਦੀ ਹੈ ਇਹਨਾਂ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਹੀ ਸਾਡਾ ਜਿਹੜਾ ਦੇਸ਼ ਹੈ ਉਹਦੇ ਵਿੱਚ ਹਰ ਦਿਨ ਜਿਹੜੀਆਂ ਦੁਰਘਟਨਾਵਾਂ ਨੇ ਉਹਨਾਂ ਵਿੱਚ ਵਾਧਾ ਹੁੰਦਾ ਜਾਂਦਾ ਹੈ ਅਤੇ ਮੈਂ ਇਹ ਅਪੀਲ ਕਰਨਾ ਚਾਹੂੰਗੀ ਵੀ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਹੀ ਆਵਾਜਾਈ ਦੇ ਸਾਧਨਾਂ ਬਾਰੇ ਬਹੁਤ ਜ਼ਿਆਦਾ ਅਵੇਅਰ ਕਰਨਾ ਚਾਹੀਦਾ ਅਤੇ ਇਹ ਵੀ ਮੈਂ ਅਪੀਲ ਕਰਨਾ ਚਾਹੂੰਗੀ ਵੀ ਜਿਹੜੇ ਛੋਟੇ ਬੱਚੇ ਨੇ ਜੇ ਸਰਕਾਰੀ ਸਕੂਲ ਨੇ ਤਾਂ ਸਰਕਾਰ ਵੱਲੋਂ ਉਹਨਾਂ ਨੂੰ ਫ੍ਰੀ ਦੇ ਵਿੱਚ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਅਤੇ ਜੇ ਕੋਈ ਹੋਰ ਆਪਾਂ ਇਸ ਗੱਲ ਦੀ ਵਰਤੋਂ ਕਰਕੇ ਲੋਕਾਂ ਨੂੰ ਸਹੂਲਤ ਦੇ ਸਕੀਏ ਵੀ ਸਸਤੀ ਤੋਂ ਸਸਤੀ ਜਿਹੜੀ ਆਵਾਜਾਈ ਦੇ ਸਾਧਨ ਨੇ ਉਹਨਾਂ ਨੂੰ ਉਹ ਮੁਹੱਈਆ ਕਰਵਾਏ ਜਾ ਸਕਣ ਅਤੇ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੋਵੇਗੀ ਧੰਨਵਾਦ